ਅਸੀਂ ਲੋਕ ਪੂਜਾ ਦੌਰਾਨ ਜਿਹੜੇ ਆ ਉਹ ਕੁਝ ਵਿਸ਼ੇਸ਼ ਅਭਿਆਸ ਕਰਦੇ ਹਾਂ ਜਿਵੇਂ ਕਿ ਸਿੱਖ ਆ ਜਿਹੜੇ ਆ ਸ਼ਬਦ ਗਾ ਕੇ ਆਪਣੀ ਜਿਹੜੀ ਆ ਆਸਥਾ ਪ੍ਰਗਟ ਕਰਦੇ ਹਨ ਪਰਮਾਤਮਾ ਦੇ ਵਿੱਚ ਹਿੰਦੂ ਜਿਹੜੇ ਉਹ ਭਜਨ ਗਾ ਕੇ ਆਪਣੇ ਭਗਵਾਨ ਦੇ ਵਿੱਚ ਆਪਣਾ ਵਿਸ਼ਵਾਸ ਵਿਖਾਉਂਦੇ ਹਨ ਮੁਸਲਮਾਨ ਕਵਾਲੀਆਂ ਗਾ ਕੇ ਜਿਹੜਾ ਆ ਆਪਣੇ ਅੱਲਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ ਇਸ ਤਰ੍ਹਾਂ ਪੰਜਾਬ ਦੇ ਵਿੱਚ ਅਸੀਂ ਪੂਜਾ ਦਾ ਜਿਹੜਾ ਆ ਜ਼ਿਆਦਾਤਰ ਗਾ ਕੇ ਹੀ ਆਪਣਾ ਦੁੱਖ ਖੁਸ਼ੀ ਦਰਦ ਜਿਹੜਾ ਉਹ ਆਪਣੇ ਰੱਬ ਨੂੰ ਭਗਵਾਨ ਨੂੰ ਅੱਲਾ ਨੂੰ ਬਿਆਨ ਕਰਦੇ ਹਾਂ